ਮੇਰੇ ਖਿਆਲ ਅਨੁਸਾਰ ਖੇਡਾਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਉਂਦੀਆਂ ਮੇਰੇ ਅਨੁਸਾਰ ਖੇਡਾਂ ਤੋਂ ਬਿਨਾਂ ਤੁਹਾਡਾ ਸਿਹਤਮੰਦ ਹੋਣਾ ਤੁਹਾਡਾ ਤੰਦਰੁਸਤ ਹੋਣਾ ਸੰਭਵ ਹੀ ਨਹੀਂ ਹੈ ਖੇਡਾਂ ਤੁਹਾਨੂੰ ਦਿਮਾਗੀ ਪੱਧਰ ਦੇ ਉੱਤੇ ਵੀ ਸਰੀਰਿਕ ਪੱਧਰ ਦੇ ਉੱਤੇ ਵੀ ਤੰਦਰੁਸਤ ਬਣਾਉਂਦੀਆਂ ਖੇਡਾਂ ਦੇ ਵਿੱਚ ਤੁਹਾਡੀ ਮਾਨਸਿਕ ਪੱਧਰ ਦੀ ਗਤੀਵਿਧੀ ਵੀ ਹੁੰਦੀ ਹੈ ਖੇਡਾਂ ਦੇ ਵਿੱਚ ਤੁਹਾਡੀ ਸਰੀਰਕ ਪੱਧਰ ਦੀ ਗਤੀਵਿਧੀ ਵੀ ਹੁੰਦੀ ਹੈ ਅਤੇ ਜਿੰਨਾ ਤੇਜ਼ੀ ਦੇ ਨਾਲ ਤੁਸੀਂ ਦਿਮਾਗ ਅਤੇ ਸਰੀਰ ਦੇ ਕੋਲੋਂ ਕੰਮ ਖੇਡਾਂ ਦੇ ਵਿੱਚ ਲੈਂਦੇ ਹੋ ਇੱਕ ਮੁਕਾਬਲੇ ਦੀ ਭਾਵਨਾ ਦੇ ਵਿੱਚ ਹੋਵੇ ਭਾਵੇਂ ਉਹ ਅਤੇ ਭਾਵੇਂ ਤੁਸੀਂ ਅਭਿਆਸ ਦੌਰਾਨ ਕਰਦੇ ਹੋ ਇਹ ਅਤੇ ਬਹੁਤ ਜ਼ਰੂਰੀ ਹੈ ਅਤੇ ਖੇਡਾਂ ਦੇ ਵਿੱਚ ਇਹ ਆ ਵੀ ਤੁਹਾਨੂੰ ਚੰਗੀ ਜਿਹੜੀ ਉਹ ਡਾਈਟ ਭੋਜਨ ਵੀ ਲੈਣਾ ਪੈਂਦਾ ਅਤੇ ਇਹ ਚੰਗੇ ਭੋਜਨ ਦੇ ਨਾਲ ਹੀ ਤੁਸੀਂ ਚੰਗੀ ਖੇਡ ਖੇਡਦੇ ਹੋ ਅਤੇ ਇਹ ਇੱਕ ਦੂਜੇ ਦੇ ਅਨੁਸਾਰ ਹੀ ਕੰਮ ਕਰਦੇ ਆ ਚੰਗੀ ਖੇਡ ਆ ਚੰਗੀ ਸਿਹਤ ਆ ਅਤੇ ਚੰਗੀ ਸਿਹਤ ਆ ਅਤੇ ਚੰਗੀ ਖੇਡ ਆ ਧੰਨਵਾਦ